ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਹਾਂ ਮੈਂ ਦੇਖਦੀ ਹਾਂ ਕਿ ਸਾਡੀ ਪੰਜਾਬੀ ਭਾਸ਼ਾ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਰਹੀ ਹੈ ਜ਼ਿਆਦਾਤਰ ਲੋਕ ਬਾਹਰ ਨੂੰ ਜਾ ਰਹੇ ਹਨ ਜਿਸ ਨਾਲ ਸਾਡੀ ਪੰਜਾਬੀ ਭਾਸ਼ਾ ਬਹੁਤ ਹੀ ਘੱਟ ਰਹੀ ਹੈ ਬਾਹਰਲੀਆਂ ਭਾਸ਼ਾਵਾਂ

ਤਰੀਕਿਆਂ ਨਾਲ ਤਬਦੀਲ ਕੀਤਾ ਗਿਆ ਹੈ ਪੰਜਾਬੀ ਭਾਸ਼ਾ ਦਾ ਸਾਡੇ ਲਈ ਹੋਣਾ ਬਹੁਤ ਜ਼ਰੂਰੀ ਹੈ ਪੰਜਾਬੀ ਭਾਸ਼ਾ ਇੱਕ ਤੌਰ 'ਤੇ ਸਾਡੇ ਵਿੱਚ ਰੋਲ ਅਦਾ ਕਰਦੀ ਹੈ ਪੰਜਾਬੀ ਤੋਂ ਬਿਨਾਂ ਪੰਜਾਬੀ ਬੋਲਣ ਲਿਖਣ ਆਦਿ ਦਾ ਸਾਨੂੰ ਢੰਗ ਹੋਣਾ ਚਾਹੀਦਾ ਹੈ ਪੰਜਾਬੀ ਬੋਲਣ ਅਤੇ ਲਿਖਣ ਵਿੱਚ ਬਹੁਤ ਹੀ ਜ਼ਿਆਦਾ ਫ਼ਰਕ ਹੁੰਦਾ ਹੈ ਖ਼ਾਸ ਕਰਕੇ ਹੋਰ ਭਾਸ਼ਾਵਾਂ ਅਤੇ ਸੱਭਿਆਚਾਰਕ 'ਤੇ ਬਹੁਤ ਹੋਰ ਭਾਸ਼ਾਵਾਂ ਕਾਰਨ ਸਭਿਆਚਾਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਜ਼ਿਆਦਾਤਰ ਲੋਕ ਬਾਹਰਲੀਆਂ ਕੰਟਰੀਆਂ ਜਿਵੇਂ ਕਿ ਕੈਨੇਡਾ ਆਸਟਰੇਲੀਆ ਯੂ ਐਸ ਏ ਆਦਿ ਵਿੱਚ ਜਾ ਰਹੇ ਹਨ ਜਿਸ ਕਾਰਨ ਉਹ ਆਪਣੀ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਅਤੇ ਨਵੀਆਂ ਭਾਸ਼ਾਵਾਂ ਨੂੰ ਹੋਂਦ ਵਿੱਚ ਲਿਆ ਰਹੇ ਹਨ ਇਸ ਨਾਲ ਵੀ ਸਾਡੀ ਭਾਸ਼ਾ 'ਤੇ ਬਹੁਤ ਜ਼ਿਆਦਾ ਡੂੰਘਾ ਪ੍ਰਭਾਵ ਪਿਆ ਹੈ ਸਾਨੂੰ ਇਸ ਵਿੱਚ ਥੋੜ੍ਹੀ ਚੇਂਜ ਕਰਨ ਦੀ ਲੋੜ ਹੈ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਸਗੋਂ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਬੋਲਣ ਵਲ਼ ਦਾ ਹੀ ਤਰੀਕਾ ਆਉਂਦਾ ਹੈ